ਪੇਂਡੂ ਖੇਤਰਾਂ ਵਿੱਚ ਸਭ ਤੋਂ ਮਹੱਤਵਪੂਰਨ ਖੇਡਾਂ ਹੀ ਹਨ ਹਰੇਕ ਵਿਅਕਤੀ ਖੇਡਾਂ ਖੇਡਦਾ ਹੈ ਅਤੇ ਆਪਣੇ ਸਰੀਰ ਨੂੰ ਫਿੱਟ ਰੱਖਦਾ ਹੈ ਖੇਡਾਂ ਵਿੱਚ ਲੋਕ ਅਨੁਸ਼ਾਸਨ ਅਤੇ ਇੱਕ ਦੂਜੇ ਨਾਲ਼ ਗੱਲਬਾਤ ਕਰਨਾ ਸਿੱਖਦੇ ਹਨ ਖੇਡਾਂ ਖੇਡਾਂ ਸਰੀਰ ਲਈ ਬਹੁਤ ਹੀ ਲਾਭਦਾਇਕ ਹਨ ਇਹ ਖੇਡਾਂ ਪੇਂਡੂ ਪਿੰਡਾਂ ਵਿੱਚ ਸਭ ਤੋਂ ਜ਼ਿਆਦਾ ਖੇਡੀਆਂ ਜਾਂਦੀਆਂ ਹਨ ਇਸ ਇਹ ਹਰੇਕ ਖੇਤਰ ਵਿੱਚ ਲੋਕ ਖੇਡਾਂ ਕਰਵਾਉਂਦੇ ਹਨ ਤੇ ਇੱਕ ਦੂਜੇ ਨਾਲ਼ ਗੱਲਬਾਤ ਕਰਦੇ ਹਨ ਅਤੇ ਇੱਕ ਦੂਜੇ ਨਾਲ਼ ਵਿਚਰਦੇ ਹਨ